ਮੈਂ ਜਸਪ੍ਰੀਤ ਕੌਰ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਹਾਂ ਮੈਂ ਆਪਣਾ ਨਿਊ ਨਵਾਂ ਕ੍ਰੈਡਿਟ ਕਾਰਡ ਐਚ ਡੀ ਐਫ ਸੀ ਬੈਂਕ ਬਰਨਾਲਾ ਵਿਖੇ ਜੋ ਕਿ ਸਾਡੇ ਪਿੰਡ ਤੋਂ ਤਿੰਨ ਚਾਰ ਕਿਲੋਮੀਟਰ ਦੂਰ ਹੈ ਉੱਥੇ ਮੈਂ ਆਪਣਾ ਨਿਊ ਕ੍ਰੈਡਿਟ ਕਾਰਡ ਅਪਲਾਈ ਕਰਨ ਦੀ ਅਰਜ਼ੀ ਪੇਸ਼ ਕੀਤੀ ਹੈ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਮੈਨੂੰ ਉਦੇਸ਼ ਦਿੱਤਾ ਹੈ ਕਿ ਨਵਾਂ ਆਧਾਰ ਕਾਰਡ ਲਿੰਕ ਕਰਨਾ ਕਿ ਮੈਨੂੰ ਆਧਾਰ ਕਾਰਡ ਲਿੰਕ ਕਰਨ ਦੀ ਜ਼ਰੂਰਤ ਹੈ ਉਹਨਾਂ ਨੇ ਮੈਨੂੰ ਕੇ ਆਈ ਸੀ ਦੇ ਅਧਾਰਿਤ ਇਸ ਤਰ੍ਹਾਂ ਲਿੰਕ ਕਰਨ ਲਈ ਕਿਹਾ ਹੈ ਇਸ ਨੂੰ ਦਰਸਾਉਂਦੇ ਹੋਏ ਕਿ ਨਵੇਂ ਕ੍ਰੈਡਿਟ ਕਾਰਡ ਲਈ ਕਿਆ ਅਰਜ਼ੀ ਆਧਾਰ ਕਾਰਡ ਲਈ ਅਰਜ਼ੀ

ਅਤੇ ਆਪਣੀਆਂ ਲੋੜਵੰਦ ਜ਼ਰੂਰਤਾਂ ਨੂੰ ਵੀ ਪੂਰਾ ਕਰ ਸਕਦੇ ਹਾਂ ਕ੍ਰੈਡਿਟ ਕਾਰਡ ਦੇ ਬਹੁਤ ਸਾਰੇ ਸੁਝਾਅ ਹਨ ਜੋ ਕਿ ਸਾਨੂੰ ਇਸ ਦੇ ਬਹੁਤ ਲਾਭ ਵੀ ਹਨ ਇਸ ਦੀਆਂ ਹਾਨੀਆਂ ਵੀ ਹਨ ਸਾਨੂੰ ਇਸ ਤੋਂ ਇਹ ਲਾਭ ਹੁੰਦਾ ਹੈ ਕਿ ਅਸੀਂ ਇਸਨੂੰ ਕਦੇ ਵੀ ਵਰਤ ਸਕਦੇ ਇਸ ਵਿੱਚ ਪੈਸਿਆਂ ਨੂੰ ਵਰਤ ਸਕਦੇ ਹਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਰ ਸਾਨੂੰ ਕੁਝ ਟਾਈਮ ਦਿੱਤਾ ਹੁੰਦਾ ਜਦੋਂ ਜਿਹੜੇ ਕਿ ਅਸੀਂ ਉਸ ਟਾਈਮ ਵਿੱਚ ਹੀ ਭਰਨੇ ਹੁੰਦੇ ਹਨ ਪੈਸੇ ਅਤੇ ਸਾਨੂੰ ਇਹ ਲੋੜਵੰਦ ਜ਼ਰੂਰਤਾਂ ਪੂਰੀਆਂ ਕਰਨ ਲਈ ਕ੍ਰੈਡਿਟ ਕਾਰਡ ਦਾ ਦਿੱਤਾ ਹੋਣਾ ਜ਼ਰੂਰੀ ਹੈ ਅਸੀਂ ਉਸ ਵਿੱਚ ਆਪਣੀ ਮਨੀ ਨੂੰ ਸੇਫ ਰੱਖ ਸਕਦੇ ਹਾਂ ਅਤੇ ਹੋਰ ਵੀ ਲੋੜਵੰਦ ਜ਼ਰੂਰਤਾਂ ਨੂੰ ਪੂਰੀਆਂ ਕਰ ਸਕਦੇ ਹਾਂ ਇਸ ਲਈ ਮੈਂ ਆਪ ਐਚ ਡੀ ਆਈ ਐਫ ਸੀ ਬੈਂਕ ਵਿੱਚ ਨਿਊ ਕ੍ਰੈਡਿਟ ਕਾਰਡ ਅਪਲਾਈ ਕਰਨ ਦੀ ਅਰਜ਼ੀ ਪੇਸ਼ ਕੀਤੀ ਹੈ ਅਤੇ ਉਹਨਾਂ ਨੇ ਮੈਨੂੰ ਉਹਦੀ ਇਸ ਲਈ ਆਧਾਰ ਕਾਰਡ ਲਿੰਕ ਕਰਨ ਦੀ ਜ਼ਰੂਰਤ ਹੈ ਇਸ ਤਰ੍ਹਾਂ ਕੰਮ ਕਰਨ ਲਈ ਮੈਨੂੰ ਆਧਾਰ ਲਿੰਕ ਕਰਨ ਦੀ ਜ਼ਰੂਰਤ ਹੈ ਅਤੇ ਫਿਰ ਹੀ ਮੇਰਾ ਕ੍ਰੈਡਿਟ ਕਾਰਡ ਅਪਲਾਈ ਹੋਵੇਗਾ ਇਸ ਦੀ ਨਿ ਨਿਰਵਿਘਨ ਪ੍ਰਕਿਰਿਆ ਲਈ ਸੁਝਾਅ ਪ੍ਰਦਾਨ ਕਰਦੇ ਹੋਏ ਉਹਨਾਂ ਨੇ ਮੈਨੂੰ ਆਧਾਰ ਕਾਰਡ ਲਿੰਕ ਕਰਨ